ਹੈਲੋ ਸਰ ਤੁਸੀਂ ਔਲਾ ਕੰਪਨੀ ਤੋਂ ਬੋਲਦੇ ਪਏ ਹੋ ਮੈਂ ਤੁਹਾਡੇ ਤੋਂ ਇੱਕ ਕਾਰ ਕਿਰਾਏ ਲਈ ਬੁੱਕ ਕਰਵਾਉਣਾ ਚਾਹੁੰਦਾ ਹਾਂ ਜੋ ਕਿ ਮੈਂ ਖੁਦ ਚਲਾਉਣੀ ਹੈ ਇਹ ਕਾਰ ਮੈਂ ਖੁਦ ਚਲਾਵਾਂਗਾ ਮੈਂ ਅਤੇ ਮੇਰਾ ਪਰਿਵਾਰ ਯਾਤਰਾ 'ਤੇ ਜਾ ਰਹੇ ਹਾਂ ਸਾਨੂੰ ਇਹ ਕਾਰ ਪੰਦਰਾਂ ਇੱਕ ਵੀਹ ਚੌਵੀ ਤੋਂ ਪੱਚੀ ਇੱਕ ਵੀਹ ਚੌਵੀ ਤੱਕ ਚਾਹੀਦੀ ਹੈ ਕਿਉਂਕਿ ਬੱਚੇ ਵੀ ਨਾਲ ਜਾ ਰਹੇ ਹਨ ਸਾਨੂੰ ਦਸ ਦਿਨ ਲੱਗ ਸਕਦੇ ਹਨ ਅਸੀਂ ਇਤਿਹਾਸਿਕ ਸਥਾਨਾਂ ਦੀ ਯਾਤਰਾ ਵਜੋਂ ਆਨੰਦਪੁਰ ਜਾ ਰਹੇ ਹਾਂ ਆਨੰਦਪੁਰ ਨਾਲ ਲੱਗਦੀਆਂ ਹੋਰ ਕਈ ਇਤਿਹਾਸਿਕ ਸਥਾਨਾਂ 'ਤੇ ਅਸੀਂ ਜਾਵਾਂਗੇ ਤੁਸੀਂ ਮੈਨੂੰ ਕਾਰ ਦੇ ਪ੍ਰਤੀ ਘੰਟਾ ਕਿਲੋਮੀਟਰ ਵਾਜਿਬ ਮੁੱਲਾਂ ਬਾਰੇ ਦੱਸ ਦਿਓ ਤਾਂ ਜੋ ਇਹ ਮੁੱਲ ਮੈਂ ਤੁਹਾਨੂੰ ਸਹੀ ਅਦਾ ਕਰ ਸਕਾਂ ਅਸੀਂ ਆਪਣੀ ਜਿੰਮੇਵਾਰੀ 'ਤੇ ਤੁਹਾਡੇ ਕਾਰ ਲੈ ਕੇ ਜਾਵਾਂਗੇ ਇਸ ਦਾ ਪੂਰਾ ਖਿਆਲ ਰੱਖਾਂਗੇ ਅਸੀਂ ਯਾਤਰਾ ਤੋਂ ਆ ਕੇ ਤੁਹਾਡੀ ਕਾਰ ਕਿਰਾਏ ਲਈ ਕਿਰਾਏ ਸਮੇਤ ਤੁਹਾਨੂੰ ਵਾਪਿਸ ਕਰ ਦੇਵਾਂਗਾ ਮੈਂ ਤੁਹਾਡਾ ਅਤਿ ਧੰਨਵਾਦੀ ਹੋਵਾਂਗਾ